ਜੇਕਰ ਅਜਿਹਾ ਕੁਝ ਹੋਵੇ ਕਿ ਮੈਨੂੰ ਭਵਿੱਖ ਦੀ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਇਹ ਦੇਖ ਸਕਾਂ ਟੈਕਨੋਲੋਜੀ ਕਿਵੇਂ ਕਿਵੇਂ ਵਿਕਸਿਤ ਹੋਈ ਹੈ ਤਾਂ ਮੈਂ ਜਾਂ ਤਾਂ ਚੀਨ ਜਾਣਾ ਚਾਹੂੰਗਾ ਜਾਂ ਅਮਰੀਕਾ ਕਿਉਂਕਿ ਇਹ ਦੋ ਦੇਸ਼ ਇਸ ਸਮੇਂ ਤਕਨੀਕ ਦੀ ਤਕਨੀਕ ਨੂੰ ਵਿਕਸਿਤ ਕਰਨ ਵਿੱਚ ਸਭ ਤੋਂ ਅੱਗੇ ਹਨ ਇਹਨਾਂ ਇਹ ਇਹਨਾਂ ਦੇ ਮੁਕਾਬਲੇ ਬਾਕੀ ਦੇਸ਼ ਅਜੇ ਕਾਫੀ ਪਿੱਛੇ ਹਨ ਅਤੇ ਉਹ ਉਹਨਾਂ ਨੂੰ ਹਾਲੇ ਕਾਫੀ ਕੁਝ ਸਿੱਖਣ ਦੀ ਜ਼ਰੂਰਤ ਹੈ ਇਸ ਲਈ ਜੇਕਰ ਅਮਰੀਕਾ ਵਿੱਚ ਕਿਤੇ ਜਾਣਾ ਹੋਵੇ ਤਾਂ ਮੈਂ ਸਿਲਕੋਨ ਵੈਲੀ ਜਾਂ ਕਿਸੀ ਵੱਡੀ ਕੰਪਨੀ ਦੇ ਹੈਡਕੁਆਟਰ ਜਾਣਾ ਪਸੰਦ ਕਰੂਗਾ ਧੰਨਵਾਦ